ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਇੱਕ ਜੂਨ ਉੱਨੀ ਸੌ ਚੁਰਾਸੀ ਬਾਈ ਦਸੰਬਰ ਸੋਲ੍ਹਾਂ ਸੌ ਉਣਹੱਤਰ ਨੌ ਜੁਲਾਈ ਦੋ ਹਜ਼ਾਰ ਪੰਜ